ਮੈਨੂੰ ਗੌਰਮਿੰਟ ਕਾਲਜ ਛੱਡ ਦੋਂਗੇ ਕਿੰਨਾ ਸਮਾਂ ਲੱਗੇਗਾ ਉੱਥੇ ਪਹੁੰਚਣ ਲਈ ਨਿਰਮਾਣਕਾਨ ਤੁਸੀਂ ਦੂਸਰਾ ਰਸਤਾ ਲੈ ਲਉ ਤਾਂ ਕਿ ਮੈਂ ਲੇਟ ਨਾ ਹੋਵਾਂ ਹੁਣ ਮ ਹੁਣ ਕਿੰਨਾ ਸਮਾਂ ਲੱਗੇਗਾ ਪਹੁੰਚਣ ਲਈ